ਮੇਰੀ ਮਨਪਸੰਦ ਜਗ੍ਹਾ ਹੈਗੀ ਹੈ ਰਾਜਸਥਾਨ ਉਹਦੇ ਵਿੱਚ ਉਦੈਪੁਰ ਜੈਸਲਮੇਰ ਇਹ ਮੇਰੀ ਮਨ ਭਉਂਦਾ ਹੈਗੀਆਂ ਇੱਥੋਂ ਦਾ ਮੈਨੂੰ ਖਾਣਾ ਉੱਥੋਂ ਦਾ ਕਲਚਰ ਉੱਥੋਂ ਦਾ ਮੌਸਮ ਜੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਉੱਥੋਂ ਦੀ ਸ਼ੋਪਿੰਗ ਵੀ ਬੜੀ ਵਧੀਆ ਅਸੀਂ ਕਲਰਫੁੱਲ ਕੱਪੜੇ ਔਰ ਉਹਨਾਂ ਦਾ ਚਟਪਟਾ ਖਾਣਾ ਔਰ ਉਹਨਾਂ ਦੀਆਂ ਜੋ ਵੀ ਪੈਲਸ ਰਾਜੇ ਮਹਾਰਾਜੇ ਦੇ ਰਹਿਣ ਵਾਲੇ ਘਰ ਉਹ ਵੇਖ ਕੇ ਮੇਰਾ ਮਨ ਬਹੁਤ ਖੁਸ਼ ਹੁੰਦਾ ਔਰ ਅਗਰ ਅਸੀਂ ਜੈਸਲਮੇਰ ਦੀ ਗੱਲ ਕਰੀਏ ਉਹਦੇ ਜੋ ਡੈਜਿਟ ਏਰੀਆ ਜੋ ਰਤੀਲਾ ਮੈਦਾਨ ਜਿਹਨੂੰ ਅਪਾਂ ਕਹਿ ਦਿੰਦੇ ਹਾਂ ਉਹ ਕਾਫੀ ਵਧੀਆ ਉੱਥੇ ਅਸੀਂ ਸਫਾਰੀ ਕਰ ਸਕਦੇ ਹਾਂ ਊਠ ਦੀ ਸਵਾਰੀ ਕਰ ਸਕਦੇ ਹਾਂ ਉੱਥੋਂ ਦਾ ਮੌਸਮ ਦਿਨ ਵੇਲੇ ਤਾਂ ਬਹੁਤ ਗਰਮ ਹੈ ਰਾਤ ਨੂੰ ਕਾਫੀ ਠੰਡਾ ਹੈ ਅਸੀਂ ਰਜਾਈਆਂ ਲੈ ਕੇ ਸੁੱਤੇ ਸੀ ਉੱਥੇ ਮੈਨੂੰ ਯਾਦ ਹੈ ਔਰ ਜੋ ਰਾਜਸਥਾਨ ਦਾ ਮਾਹੌਲ ਹੈ ਉਹ ਮੈਨੂੰ ਬਹੁਤ ਵਧੀਆਂ ਲੱਗਦਾ ਧੰਨਵਾਦ